ਮੇਰੀ ਤੈਕਨੋਲੋਜੀ ਵਿੱਚ ਦਿਲਚਸਪੀ ਦਾ ਆਰੰਭ ਸਭ ਤੋਂ ਪਹਿਲਾਂ ਇਸ ਸਮਝ ਨਾਲ ਹੋਇਆ ਕਿ ਇਹ ਜਿਵੇਂ ਸਮਾਜਿਕ ਅਤੇ ਵਿਦ ਵਪਾਰਕ ਸੰਬੰਧਾਂ ਨੂੰ ਬੇਹੱਦ ਬੇਹੱਦ ਮਨਾਉਣਾ ਬਿਹਤਰ ਬਣਾਉਣ ਵਿੱਚ ਸਹਾਇਕ ਹੈ ਮੈਨੂੰ ਯਾਦ ਹੈ ਜਦੋਂ ਮੈਂ ਪਹਿਲਾਂ ਪਹਿਲੀ ਵਾਰ ਇੰਟਰਨੈਟ ਅਤੇ ਸ਼ੋਸ਼ਲ ਮੀਡੀਆ ਦੇ ਜ਼ਰੀਏ ਦੁਨੀਆਂ ਭਰ ਵਿੱਚ ਲੋਕਾਂ ਨਾਲ ਸੰਪਰਕ ਕੀਤਾ ਤਾਂ ਉਸ ਅਤੇ ਤਜਰਬੇ ਨੇ ਮੈਨੂੰ ਇਹ ਸਮਝਾਇਆ ਕਿ ਤਕਨੋਲਜੀ ਨਾਲ ਸਮਾਜਿਕ ਅਤੇ ਸਮਾਜਿਕ ਅਤੇ ਵਿਅਕਤੀਗਤ ਜ਼ਿੰਦਗੀ ਵਿੱਚ ਇੱਕ ਸਥਾਈ ਅਤੇ ਮਾਈ ਮਾਇਨੇਦਾਰ ਕਨੈਕਸ਼ਨ ਬਣ ਸਕਦਾ ਹੈ ਤਕਨੋਲੋਜੀ ਨੇ ਮੈਨੂੰ ਸ ਸੰਪਰਕ ਬਣਾਉਣ ਅਤੇ ਸਿੱਖਣ ਦੇ ਤਰੀਕੇ ਨੂੰ ਬਦਲ ਕੇ ਇੱਕ ਨਵਾਂ ਦ੍ਰਿਸ਼ਟੀਕੋਣ ਦਿੱਤਾ ਹੈ ਇਸ

ਸਰਫ ਸਫਰ ਅਤੇ ਆਵਾ ਆਵਾਜਾਈ ਦੇ ਮਾਧਿਅਮਾਂ ਵਿੱਚ ਕਿੰਨੀ ਵਿਦਿਆਈ ਵਿਦਿਆਈ ਕੀਤੀ ਹੈ ਨਵੀਂ ਤਕਨੋਲਜੀ ਦੀ ਵਰਤੋਂ ਨਾਲ ਸੜਕਾਂ ਰੇਲਵੇ ਸਟੇਸ਼ਨਾਂ ਅਤੇ ਹਵਾਈ ਸਫਰ ਜਿਵੇਂ ਤਰੀਕੇ ਜ਼ਿਆਦਾ ਤੇਜ਼ ਸੁਰੱਖਿਅਤ ਅਤੇ ਕਾਫੀ ਸਸਤੇ ਹੋ ਗਏ ਹਨ ਆਸ ਕਰਦਾ ਹਾਂ ਕਿ ਤੁਹਾਨੂੰ ਮੇਰਾ ਇਹ ਟੋਪਿਕ ਚੰਗਾ ਲੱਗੇਗਾ ਧੰਨਵਾਦ